ਸਾਡੇ ਸੱਭਿਆਚਾਰ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਵਧੀਆ ਕੀਤੀਆਂ ਜਾਂਦੀਆਂ ਹਨ ਵਿਆਹ ਵਿੱਚ ਹਲਦੀ ਲੋਕ ਨਾਚ ਗਿੱਧਾ ਮੁੰਡੇ 'ਤੇ ਭਾਬੀਆਂ ਸੁਰਮਾ ਪਾਉਂਦੀਆਂ ਹਨ ਅਤੇ ਜੇਕਰ ਅਸੀਂ ਸੁਰਮਾ ਪਾਉਂਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਪ੍ਰਾਪਤੀ ਮਿਲਦੀ ਹੈ ਅਤੇ ਇਸ ਕਰਕੇ ਰਸਮਾਂ ਜਦੋਂ ਮੁੰਡੇ ਦੀ ਡੋਲੀ ਤੁਰਦੀ ਹੈ ਉਦੋਂ ਗੀਤ ਗਾਏ ਜਾਂਦੇ ਹਨ ਅਤੇ ਜਦੋਂ ਕੁੜੀ ਨੂੰ ਘਰ ਤੋਂ ਸਹੁਰੇ ਘਰ ਤੋਰਦੇ ਹਨ ਉਦੋਂ ਗੀਤ ਗਾਏ ਜਾਂਦੇ ਹਨ ਅਤੇ ਮੁੰਡੇ ਦੀ ਭਾਬੀ ਮਤਲਬ ਮੁੰਡੇ ਦੀਆਂ ਮੁੰਡੇ ਜਿਹੜੀਆਂ ਸਾਲੀਆਂ ਉਹ ਬਾਰ ਰੋਕਦੀਆਂ ਬਾਰ ਰੁਕਾਈ ਦੇ ਪੈਸੇ ਲੈਂਦੀਆਂ ਜੁੱਤੀ ਲੁਕੋ ਦਿੰਦੀਆਂ ਮਹਿੰਦੀ ਲਾਉਂਦੀਆਂ ਪਤਾਸੇ ਪੁਆਉਦੀਆਂ ਕਈ ਰਸਮਾਂ ਸਾਲੀਆਂ ਕਰਦੀਆਂ ਹਨ ਅਤੇ ਕੁੜੀ ਮੁੰਡੇ ਦੀਆਂ ਭੈਣਾਂ ਆਪ ਦੀ ਮਤਲਬ ਘਰ ਵਾਲੇ ਨੂੰ ਲੈ ਕੇ ਘਰ ਜਾਂਦਾ ਅਤੇ ਉੱਥੇ ਉਸਦੀਆਂ ਭੈਣਾਂ ਬਾਰ ਰੋਕਦੀਆਂ ਹਨ ਅਤੇ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਘਰ ਵਿੱਚ ਘਰ ਵਿੱਚ ਸਤਿਕਾਰ ਆਦਰ ਨਾਲ ਮਤਲਬ ਸਤਿਕਾਰ ਕਰਦੇ ਘਰ ਵਿੱਚ ਜੀ ਆਇਆ ਨੂੰ ਕਹਿੰਦੀਆਂ ਹਨ ਭੈਣਾਂ ਬਹੁਤ ਵਧੀਆ ਮਤਲਬ ਵਧੀਆ ਕਰਦੀਆਂ ਹਨ ਅਤੇ ਸਾਲੀਆਂ ਮੁੰਡਾ ਸਾਲੀਆਂ ਨੂੰ ਪੈਸੇ ਦਿੰਦਾ ਹੈ ਉਹ ਰਸਮਾਂ ਕਰਦੇ ਹਨ ਅਤੇ ਜਦੋਂ ਕੁੜੀ ਅਤੇ ਮੁੰਡਾ ਮੁੰਡਾ ਕੁੜੀ ਨੂੰ ਵਿਆਹ ਕੇ ਘਰ ਲੈ ਕੇ ਆਉਂਦਾ ਅਤੇ ਉਸਦੀ ਮਾਂ ਪਾਣੀ ਵਾਰਦੀ ਆ ਮਿੱਠਾ ਖਵਾਉਂਦੀ ਆ ਅਤੇ ਹੋਰ ਕੁਛ ਵਾਹਵਾ ਤਰ੍ਹਾਂ ਦੀਆਂ ਰਸਮਾਂ ਕਰਦੀਆਂ ਹਨ ਮਾਵਾਂ ਵੀ ਕਰਦੀਆਂ ਸਾਲੀਆਂ ਭੈਣਾਂ ਅਤੇ ਜਦੋਂ ਮੁੰਡੇ ਦੀ ਨਹਾਈ ਧੋਆਈ ਹੁੰਦੀ ਹੈ ਅਤੇ ਉਦੋਂ ਮਾਮਾ ਚੱਕਦਾ ਹੈ ਅਤੇ ਠੁੱਠੀ ਭੰਨ੍ਹਦਾ ਹੈ ਅਤੇ ਕੁੜੀ ਦਾ ਵੀ ਮਾਮਾ ਚੱਕ ਕੇ ਠੁੱਠੀ ਭੰਨ੍ਹਦਾ ਹੈ